ਮੈਨੂੰ ਮਛੇਰਿਆਂ ਵਾਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਨਾ ਕਿ ਮੈਂ ਮੱਛੀਆਂ ਖਾਂਦੀ ਹਾਂ ਅਤੇ ਨਾ ਹੀ ਮੈਂ ਮੱਛੀਆਂ ਪਸੰਦ ਕਰਦੀ ਹਾਂ